ਦੁੱਧ ਚੋਣ ਦੀਆਂ ਬਹੁਤ ਇੱਕ ਦੋ ਤਕਨੀਕਾਂ ਹਨ ਵੈਸੇ ਤਾਂ ਜਿਵੇਂ ਕਿ ਦੁੱਧ ਚੋਣ ਪਹਿਲਾਂ ਮੱਝਾਂ ਦੇ ਥਣਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਗੋਡਿਆਂ ਦੇ ਭਾਰ ਬਹਿ ਕੇ ਬਾਲਟੀ ਨੂੰ ਗੋਡਿਆਂ ਦੇ ਵਿੱਚ ਫਸਾ ਕੇ ਉਹ ਉਹਦੇ ਨਾਲ ਦੁੱਧ ਚੋਇਆ ਜਾ ਸਕਦਾ ਹੈ ਨੰਬਰ ਦੋ ਦੁੱਧ ਅਤੇ ਹੋਰ ਵੀ ਤਕਨੀਕਾਂ ਹਨ ਜਿਵੇਂ ਕਿ ਅਤੇ ਮਸ਼ੀਨਾਂ ਨਾਲ ਵੀ ਦੁੱਧ ਚੋਇਆ ਜਾ ਸਕਦਾ ਹੈ ਜਿਵੇਂ ਅਸੀਂ ਮਸ਼ੀਨਾ ਹੁੰਦੀਆਂ ਹਨ ਉਹਦਾ ਕੰਮ ਹੁੰਦਾ ਹੈ ਉਹ ਉਹਨਾਂ ਦੇ ਥਣਾ ਦੇ ਨਾਲ ਲਗਾ ਦਿੱਤਾ ਜਾਂਦਾ ਹੈ ਜਿਹਦੇ ਕਰ ਉਹ ਵੈਕਿਊਮ ਪੈਦਾ ਕਰਦੀਆਂ ਅਤੇ ਵੈਕਿਊਮ ਦੇ ਨਾਲ ਉਹਨਾਂ ਦੇ ਥਣਾਂ ਚੋਂ ਦੁੱਧ ਨਿਕਲਿਆ ਆਉਂਦਾ ਹੈ ਇਹਦੇ ਨਾਲ ਵੀ ਅਸੀਂ ਦੁੱਧ ਇਹ ਤਕਨੀਕ ਕਰ ਸਕਦੇ ਹਾਂ ਹੋਰ ਦੁੱਧ ਚੋਣ ਦੀਆਂ ਕਾਫੀ ਤਕਨੀਕਾਂ ਹੁੰਦੀਆਂ ਹਨ ਜਿਵੇਂ ਬੈਠ ਕੇ ਵੀ ਚੋਇਆ ਜਾ ਸਕਦਾ ਹੈ ਖੜੇ ਹੋ ਕੇ ਵੀ ਚੋਇਆ ਜਾ ਸਕਦਾ ਹੈ ਹੋਰ ਮਤਲਬ ਕਿ ਦੁੱਧ ਚੋਣ ਦੀਆਂ ਇਹ ਤਕਨੀਕਾਂ ਹੀ ਵਧੀਆ ਅਤੇ ਸਕਸੈਸਫੁਲ ਰਹਿੰਦੀਆਂ ਹਨ ਇਸ ਦੇ ਨਾਲ ਮੱਝ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਮਤਲਬ ਤਕਲੀਫ ਨਹੀਂ ਹੁੰਦੀ ਦੁੱਧ ਚੋਣ ਤੋਂ ਉਹ ਬੇਫ ਮਤਲਬ ਕਿ ਆਸਾਨੀ ਨਾਲ ਦੁੱਧ ਚੁਵਾ ਦਿੰਦੀ ਹੈ